ਅਸੀਂ ਕਿਤਾਬਾਂ ਬੁੱਕ ਸਟੋਰ ਤੋਂ ਹੀ ਖਰੀਦਦੇ ਹਾਂ ਅਤੇ ਸਾਡੇ ਆਸ ਪਾਸ ਕਈ ਸਸਤੇ ਸੈਕਿੰਡ ਹੈਂਡ ਬੁੱਕ ਸਟੋਰ ਹਨ ਜਿੱਥੋਂ ਸਾਨੂੰ ਬਿਲਕੁਲ ਹੀ ਸਹੀ ਕੀਮਤ 'ਤੇ ਕਿਤਾਬਾਂ ਮਿਲ ਜਾਂਦੀਆਂ ਹਨ ਅਗਰ ਪਾਠਕ੍ਰਮ ਜ਼ਿਆਦਾ ਨਾ ਬਦਲਿਆ ਹੋਵੇ ਤਾਂ ਸ ਅਸੀਂ ਸੈਕਿੰਡ ਹੈਂਡ ਬੁੱਕ ਹੀ ਖਰੀਦ ਲੈਂਦੇ ਹਾਂ ਅਤੇ ਉਹਦੇ ਨਾਲ ਪ ਪੈਸੇ ਦੀ ਬਚਤ ਹੋ ਜਾਂਦੀ ਹੈ ਅਤੇ ਸਾਨੂੰ ਸੁਵਿਧਾ ਵੀ ਹੁੰਦੀ ਹੈ ਅਤੇ ਜਿਹੜੇ ਸਾਡੇ ਆਸ ਪਾਸ ਬੁੱਕ ਸਟੋਰ ਹਨ ਅਤੇ ਉਹ ਸਾਡੇ ਕੋਲ ਕਿਤਾਬਾਂ ਫੇਰ ਸਹੀ ਕੀਮਤ 'ਤੇ ਵਾਪਸ ਵੀ ਲੈ ਲੈਂਦੇ ਹਨ ਅਤੇ ਜਿਸ ਜਗ੍ਹਾ 'ਤੇ ਅਸੀਂ ਅਗਲੀਆਂ ਨਵੀਆਂ ਕਿਤਾਬਾਂ ਵੀ ਖਰੀਦ ਸਕਦੇ ਹਨ ਅਤੇ ਆ ਜਿਹੜੇ ਸਾਡੇ ਆਸ ਪਾਸ ਬੁੱਕ ਸਟੋਰ ਹਨ ਉਹ ਬੜੇ ਹੀ ਹੈਲਪਫੁੱਲ ਹਨ ਅਤੇ ਉਹ ਕਾਫੀ ਸਾਡੀ ਸਹਾਇਤਾ ਕਰਦੇ ਹਨ